ਗਤਕੇ ਦੇ ਇਤਿਹਾਸ ਸਮ ਇਤਿਹਾਸ ਅਤੇ ਕੁਝ ਘੱਟ ਜਾਣੇ ਵਾਲੇ ਪਹਿਲੂਆਂ ਦੀ ਆਮ ਤੌਰ 'ਤੇ ਗੱਲ ਕਰਦੇ ਹਾਂ ਗਤਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਜਿਸ ਦੀ ਵਰਤੋਂ ਅੱਜ ਤੱਕ ਦੁਸ਼ਮਣਾਂ ਤੋਂ ਬਚਣ ਲਈ ਅਤੇ ਆਪਣਾ ਬਚਾਅ ਕਰਨ ਲਈ ਕੀਤੇ ਜਾਂਦੀ ਸੀ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਡੰਡਾ ਸੋਟੀ ਤਲਵਾਰ ਖੰਡਾ ਢਾਲ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦੀ ਵਰਤੋਂ ਖੁਦ ਦੇ ਬਚਾਅ ਅਤੇ ਦੂਜੇ ਦੇ ਬਚਾਅ ਲਈ ਕੀਤੀ ਜਾਂਦੀ ਹੈ ਜਦੋਂ ਦੁਸ਼ਮਣਾਂ ਦੁਆਰਾ ਬਹੁਤ ਸਮਾਂ ਪਹਿਲਾਂ ਹਮਲੇ ਕੀਤੇ ਜਾਂਦੇ ਸਨ ਤਾਂ ਉਦੋਂ ਗਤਕੇ ਦੀ ਪ੍ਰਥਾ ਸ਼ੁਰੂ ਕੀਤੀ ਗਈ ਖੰਡੇ ਦੀ ਪਾਹੁਲ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਤਕੇ ਦੀ ਪ੍ਰਥਾ ਨੂੰ ਸ਼ੁਰੂ ਕਰ ਦਿੱਤਾ ਸੀ ਇਸ ਦੀ ਵਰਤੋਂ ਖੁਦ ਦੇ ਅਤੇ ਦੂਜਿਆਂ ਦੇ ਬਚਾਅ ਲਈ ਆਮ ਤੌਰ 'ਤੇ ਕੀਤੀ ਜਾਂਦੀ ਹੈ ਗੱਤਕੇ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਨੂੰ ਵਿਆਪਕ ਤੌਰ 'ਤੇ ਆਪਾਂ ਨਹੀਂ ਦੱਸ ਸਕਦੇ ਪਰ ਇਸ ਦੀ ਵਰਤੋਂ ਆਮ ਤੌਰ 'ਤੇ ਅਸੀਂ ਗਤਕੇ ਨੂੰ ਮਾਨਸਿਕ ਅਤੇ ਸਰੀਰਿਕ ਦੋਵਾਂ ਤੌਰ 'ਤੇ ਖੇਡਿਆਂ ਜਾਂਦ ਜਾਂਦਾ ਹੈ ਮਾਨਸਿਕ ਤੌਰ 'ਤੇ ਉਸੇ ਜਗ੍ਹਾ 'ਤੇ ਪੂਰੇ ਹੋਣ ਲਈ ਸਾਨੂੰ ਗਤਕੇ ਦੀ ਬਹੁਤ ਸਹਾਇਤਾ ਮਿਲਦੀ ਹੈ ਗਤਕਾ ਸਾਨੂੰ ਆਮ ਤੌਰ 'ਤੇ ਦੁਸ਼ਮਣ ਨਾਲ ਲੜਨਾ ਅਤੇ ਗੱਲ ਕਰਨਾ ਸਿਖਾਉਂਦਾ ਹੈ ਇਸ ਦੀ ਵਰਤੋਂ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਗਤਕੇ ਵਿੱਚ ਸਾਨੂੰ ਦੁਸ਼ਮਣ ਨਾਲ ਲੜਨ ਅਤੇ ਉਹਨਾਂ ਦੇ ਉੱਤੇ ਬਲ ਦਾ ਪ੍ਰਯੋਗ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ ਅਸੀਂ ਦੱਸਦੇ ਹਾਂ ਕਿ ਗਤਕਾ ਸਾਡੇ ਲਈ ਸਰੀਰਕ ਅਤੇ ਮਾਨਸਿਕ ਉਪਯੋਗ ਪੈਦਾ ਕਰਦਾ ਹੈ ਇਸੇ ਤਰ੍ਹਾਂ ਹੀ ਅਸੀਂ ਗੱਤਕੇ ਨੂੰ ਪੂਰੇ ਤਰੀਕੇ ਨਾਲ ਲੈਂਦੇ ਹਾਂ ਅਤੇ ਸਕਾਰਾਤਮਕ ਸੋਚ ਨੂੰ ਪੈਦਾ ਕਰਦੇ ਹਾਂ